ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਅੱਧੇ ਤੋਂ ਜ਼ਿਆਦਾ ਲੋਕ ਖੇਤੀਬਾੜੀ ਦੇ ਨਾਲ ਹੀ ਜੁੜੇ ਹੋਏ ਹਨ ਅਤੇ ਖੇਤੀਬਾੜੀ ਮਤਲਬ ਕੁਝ ਕਿਸਾਨਾਂ ਕੋਲ ਬਹੁਤ ਜ਼ਿਆਦਾ ਜ਼ਮੀਨ ਅਤੇ ਕੁਝ ਕਿਸਾਨਾਂ ਕੋਲ ਬਹੁਤ ਘੱਟ ਖੇਤੀਬਾੜੀ ਹੀ ਹੈ ਜਿਸ ਨਾਲ ਜ਼ਿਆਦਾਤਰ ਲੋਕਾਂ ਦੇ ਪੰਜਾਬ ਵਿੱਚ ਘਰ ਚਲਦੇ ਹਨ ਅਤੇ ਖੇਤੀਬਾੜੀ ਦਾ ਕਾਰੋਬਾਰ ਕਰਦੇ ਹਨ ਲੋਕ ਅਤੇ ਜੋ ਵੱਡੇ ਖੇਤਰ ਦੇ ਕਿਸਾਨ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦੇ ਹਨ ਅਤੇ ਬਹੁਤ ਜ਼ਿਆਦਾ ਉਹਨਾਂ ਨੇ ਤਰੱਕੀ ਕਰ ਲਈ ਹੈ ਅੱਜ ਉਹਨਾਂ ਕੋਲ ਕਾਫੀ ਜ਼ਿਆਦਾ ਪੈਸਾ ਹੈ ਆਪਣੇ ਚੱਜ ਦੇ ਘਰ ਬਣਾ ਚੁੱਕੇ ਹਨ ਆਪਣੀ ਜ਼ਮੀਨਾਂ ਵੀ ਵਧਾ ਚੁੱਕੇ ਹਨ ਅਤੇ ਆਪਣੀ ਹੋਰ ਜ਼ਮੀਨਾਂ ਵਧਾ ਰਹੇ ਹਨ ਕਿਉਂਕਿ ਇਹਨਾਂ ਦੇ ਕੋਲ ਜ਼ਮੀਨ ਜ਼ਿਆਦਾ ਹੈ ਅਤੇ ਜ਼ਮੀਨ ਜ਼ਿਆਦਾ ਹੈ ਅਤੇ ਜਿਸ ਨਾਲ ਉਹਨਾਂ ਨੂੰ ਫਾਇਦਾ ਵੀ ਜ਼ਿਆਦਾ ਹੁੰਦਾ ਅਤੇ ਜਿਸ ਨਾਲ ਆਪਣੇ ਆਪਣੀ ਤਰੱਕੀ ਕਰ ਰਹੇ ਹਨ ਅਤੇ ਅੱਗੇ ਵੱਧ ਰਹੇ ਹਨ ਪਰ ਕਾਫੀ ਸਾਰੇ ਕਾਫੀ ਕਿਆ ਅੱਧੇ ਤੋਂ ਜ਼ਿਆਦਾ ਵੀ ਅੱਧੇ ਤੋਂ ਜ਼ਿਆਦਾ ਵੀ ਜ਼ਿਆਦਾ ਹੋ ਗਿਆ ਬਹੁਤ ਘੱਟ ਕਿਸਾਨ ਹਨ ਜਿਹਨਾਂ ਕੋਲ ਵੱਡੇ ਖੇਤਰ ਦੇ ਵਿੱਚ ਜ਼ਮੀਨ ਹੈ ਬਟ ਬਹੁਤ ਜ਼ਿਆਦਾ ਕਿਸਾਨ ਉਹੀ ਆ ਜਿਹਨਾਂ ਕੋਲ ਬਹੁਤ ਹੀ ਘੱਟ ਜ਼ਮੀਨ ਹੈ ਅਤੇ ਛੋਟੇ ਹਿੱਸੇ ਜ਼ਮੀਨ ਆ ਉਹਨਾਂ ਦੇ ਕੋਲ ਬਹੁਤ ਛੋਟਾ ਹਿੱਸਾ ਜ਼ਮੀਨ ਆਉਂਦੀ ਹੈ ਜਿਸ ਨਾਲ ਉਹਨਾਂ ਨੇ ਖੇਤੀ ਵੀ ਕਰਨੀ ਹੁੰਦੀ ਅਤੇ ਉਸ ਤੋਂ ਬਾਅਦ ਵਿੱਚ ਉਸ ਦਾ ਹੀ ਉਸ ਦੇ ਨਾਲ ਹੀ ਆਪਣੇ ਘਰ ਦਾ ਵੀ ਗੁਜ਼ਾਰਾ ਕਰਨਾ ਹੁੰਦਾ ਜੋ ਵੱਡੇ ਖੇਤਰ ਦੇ ਕਿਸਾਨ ਹਨ ਉਹ ਆ ਉਹਨਾਂ ਦੇ ਕੋਲ ਕਮਾਈ ਕਾਫੀ ਜ਼ਿਆਦਾ ਹੈ ਜਿਸ ਨਾਲ ਉਹ ਆਪਣੇ ਵਿੱਚ ਜੋ ਮੋਡਰਨ ਟੂਲ ਅੱਜ ਕੱਲ੍ਹ ਆਏ ਹਨ ਉਹ ਯੂਜ਼ ਕਰ ਰਹੇ ਹਨ ਜਿਸ ਨਾਲ ਉਸਨੂੰ ਖੇਤੀ ਵਿੱਚ ਵੀ ਨੁਕਸਾਨ ਹੋ ਰਿਹਾ ਉਹਨਾਂ ਦੀ ਫਸਲਾਂ ਦੀ ਵੱਧ ਰਹੀਆਂ ਹਨ ਅਤੇ ਮਿਹਨਤ ਵੀ ਉਹਨਾਂ ਦੀ ਬਹੁਤ ਜ਼ਿਆਦਾ ਘੱਟ ਗਈ ਹੈ ਅਤੇ ਦੂਜੇ ਪਾਸੇ ਜਿਹੜੇ ਛੋਟੇ ਖੇਤਰ ਦੇ ਕਿਸਾਨ ਹਨ ਉਹਨਾਂ ਦੀ ਮਿਹਨਤ ਵੀ ਓਨੀ ਹੈ ਉਹਨਾਂ ਨੂੰ ਬਚਦਾ ਵੀ ਕੁਛ ਨਹੀਂ ਅਤੇ ਉਹ ਅੱਜ ਵੀ ਜਿੱਥੇ ਪਹਿਲਾਂ ਸੀ ਉੱਥੇ ਹੀ ਹਨ ਜੋ ਤਰੱਕੀ ਕੀਤੀ ਹੈ ਉਹ ਸਿਰਫ ਵੱਡੇ ਖੇਤਰ ਦੇ ਲੋਕਾਂ ਨੇ ਹੀ ਕੀਤੀ ਹੈ ਆ ਜੋ ਵੱਡੇ ਖੇਤਰ ਉਹਨਾਂ ਨੇ ਆਪਣੇ ਤਾਂ ਖੇਤਾਂ ਵਿੱਚ ਸਾ ਟਿਊਬਲ ਲਗਾ ਰੱਖਿਆ ਜਿਸ ਨਾਲ ਉਹ ਟਾਈਮ ਟੂ ਟਾਈਮ ਜਦੋਂ ਵੀ ਲੋੜ ਹੋਵੇ ਆਪਣੇ ਆ ਆਪਣੇ ਖੇਤਾਂ ਨੂੰ ਪਾਣੀ ਦੇ ਸਕਦੇ ਆ ਜਦ ਉਹਨਾਂ ਨੂੰ ਲੱਗੇ ਦੇ ਸਕਦੇ ਹਨ ਛੋਟੇ ਖੇਤ ਜੋ ਛੋਟੇ ਖੇਤਾਂ ਵਾਲੇ ਕਿਸਾਨ ਹਨ ਉਹਨਾਂ ਕੋਲ ਇਹ ਇਹ ਜਿਹੀ ਕੋਈ ਵੀ ਫੈਸਿਲਿਟੀ ਨਹੀਂ ਹੈ ਉਹ ਟਿਊਬਲ ਵੀ ਨਹੀਂ ਲਗਾ ਸਕਦੇ ਕਿਉਂਕਿ ਜੋ ਉਹਨਾਂ ਕੋਲ ਜ਼ਮੀਨ ਦਾ ਹਿੱਸਾ ਹੈ ਬਹੁਤ ਜ਼ਿਆਦਾ ਛੋਟਾ ਹੈ ਅਤੇ ਉਹਦੇ ਉੱਪਰ ਟਿਊਬਲ ਲਗਾਣਾ ਉਹ ਅਫੋਰਡ ਵੀ ਨਹੀਂ ਕਰ ਸਕਦੇ ਅਤੇ ਜੋ ਵੱਡੇ ਖੇ ਅਤੇ ਉਹਨਾਂ ਨੂੰ ਮੋਸਟਲੀ ਜੋ ਸਰਕਾਰ ਵੱਲੋਂ ਪਾਣੀ ਦਿੱਤਾ ਜਾਂਦਾ ਜਾਂ ਸਰਕਾਰ ਵੱਲੋਂ ਕੋਈ ਸਕੀਮ ਲੈ ਕੇ ਆਈ ਜਾਂਦੀ ਹੈ ਜਿਸ ਨਾਲ ਉਹਨਾਂ ਨੂੰ ਪਾਣੀ ਮਿਲ ਸਕੇ ਉਹੀ ਵਰਤਦੇ ਹਨ ਜਿਸ ਕਰਕੇ ਨਾ ਉਹਨਾਂ ਦੇ ਕੋਲ ਇੰਨਾ ਪੈਸਾ ਹੈ ਕਿ ਜੋ ਮੋਡਰਨ ਟੂਲ ਅੱਜ ਕੱਲ੍ਹ ਦੇ ਵਿੱਚ ਆਏ ਹਨ ਜਿਨਾਂ ਨੇ ਖੇਤੀਬਾੜੀ ਦੇ ਕੰਮਾਂ ਨੂੰ ਬਹੁਤ ਜ਼ਿਆਦਾ ਆਸਾਨ ਬਣਾ ਦਿੱਤਾ ਹੈ ਨਾ ਉਹ ਉਹ ਲੈ ਸਕਦੇ ਹਨ ਕਿਉਂਕਿ ਉਹਨਾਂ ਦੇ ਕੋਲ ਜ਼ਮੀਨ ਘੱਟ ਹੈ ਅਤੇ ਪੈਸਾ ਵੀ ਇੰਨਾ ਨਹੀਂ ਅਤੇ ਔਖੇ ਖੇ ਵੱਡੇ ਖੇਤੀ ਵਾਲੇ ਵਾਲੇ ਕਾਰੋਬਾਰ ਹੈ ਉਹ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੇ ਹਨ ਜੋ ਛੋਟੇ ਕਿਸਾਨ ਹਨ ਉਹ ਅੱਜ ਵੀ ਉੱਥੇ ਹੀ ਖੜ੍ਹੇ ਹਨ ਅਤੇ ਇੱਕ ਸਰਕਾਰ ਨੂੰ ਬਹੁਤ ਸਾਰੇ ਫੈਸਲੇ ਲੈਣ ਦੀ ਲੋੜ ਹੈ ਅਤੇ ਉਹਨਾਂ ਦੇ ਭਲਾਈ ਦੇ ਲਈ ਬਹੁਤ ਸਕੀਮਾਂ ਲੈ ਕੇ ਆਉਣ ਦੀ ਲੋੜ ਹੈ ਜੋ ਛੋਟੇ ਕਿ ਕਿਸਾਨ ਹਨ ਉਹ ਵੀ ਤਰੱਕੀ ਕਰ ਸਕੇ ਅਤੇ ਅੱਗੇ ਵੱਧ ਸਕੇ